ਮੈਂ ਨਿੱਜੀ ਤੌਰ 'ਤੇ ਟਾਸਕਰੈਬਿਟ ਜਾਂ ਫੀਵਰ ਵਰਗੀਆਂ ਸੇਵਾਵਾਂ ਦੀ ਵਰਤੋਂ ਨਹੀਂ ਕੀਤੀ ਪਰ ਮੈਂ ਇਹਨਾਂ ਪਲੇਟਫਾਰਮਾਂ ਦੇ ਨਾਲ ਆਮ ਉਪਭੋਗਤਾਵਾਂ ਅਨੁਭਵਾਂ ਦੀ ਜਾਣਕਾਰੀ ਪ੍ਰਦਾਨ ਕਰ ਸਕਦਾ ਹਾਂ ਬਹੁਤ ਸਾਰੇ ਲੋਕ ਇਹਨਾਂ ਵਰਚੁਅਲ ਨਿੱਜੀ ਸਹਾਇਕ ਸੇਵਾਵਾਂ ਨੂੰ ਆਊਟਸੋਰਸਿੰਗ ਕਾਰਜਾਂ ਜਾਂ ਪ੍ਰੋਜੈਕਟਾਂ ਨੂੰ ਕੁਸ਼ਲਤਾ ਨਾਲ ਕਰਨ ਲਈ ਕਾਫੀ ਲਾਭਦਾਇਕ ਸਮਝਦੇ ਹਨ ਉਦਾਹਰਣ ਲਈ ਟਾਸਕਰੈਬਰੈਬਟ ਉਪਭੋਗਤਾਵਾਂ ਨੂੰ ਵੱਖ ਵੱਖ ਕੰਮਾਂ ਲਈ ਫਰਨੀਚਰ ਅਸੈਂਬਲੀ ਤੋਂ ਲੈ ਕੇ ਘਰ ਦੀ ਮੁਰੰਮਤ ਤੱਕ ਮੁਰੰਮਤ ਤੱਕ ਲਚਕਤਾ ਅਤੇ ਸਹੂਲਤ ਪ੍ਰਦਾਨ ਕਰਨ ਲਈ ਵਿਅਕਤੀਆਂ ਨੂੰ ਨਿ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ ਫਾਈਬਰ ਦੂਜੇ ਪਾਸੇ ਫਰੀਲਾਂਸਰਾਂ ਲਈ ਗਰਾਫਿਕ ਡਿਜ਼ਾਇਨ ਲਿਖਣ ਅਤੇ ਪ੍ਰੋਗਰਾਮਿੰਗ ਸਮੇਤ ਸੇਵਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇੱਕ ਪਲੇਟਫਾਰਮ ਪੇਸ਼ ਕਰਦਾ ਹੈ ਉਪਭੋਗਤਾ ਅਕਸਰ ਇਹਨਾਂ ਪਲੇਟਫਾਰਮਾਂ ਦੀ ਪਹੁੰਚਯੋਗਤਾ ਅਤੇ ਸਮਰੱਥ ਦੀ ਸਮਰੱਥਾ ਦੀ ਕਦਰ ਕਰਦੇ ਹਨ ਕਿਉਂਕਿ ਉਹ ਮੁਕਾਬਲੇ ਵਾਲੀਆਂ ਦਰਾਂ ਅਤੇ ਆਪਣੇ ਜ਼ਰੂਰਤਾਂ ਦੇ ਅਨੁਕੂਲ ਪੇਸ਼ੇਵਰਾਂ ਨੂੰ ਜਲਦੀ ਲੱਭ ਸਕਦੇ ਹਨ ਹਾਲਾਂਕਿ ਕੁਝ ਕਮੀਆਂ ਵੀ ਹਨ ਕੰਮ ਦੀ ਗੁਣਵੱਤਾ ਅਸੰਗਤ ਹੋ ਸਕਦੀ ਹੈ ਕਿਉਂਕਿ ਫਲਾਂਸਰਾਂ ਜਾਂ ਕੰਮ ਕਰਨ ਵਾਲੇ ਮੁਹਾਰਤ ਵਿੱਚ ਬਹੁਤ ਵੱਖਰੇ ਹੁੰਦੇ ਹਨ ਇਸ ਤੋਂ ਇਲਾਵਾ ਉਮੀਦਵਾਰਾਂ ਦੀ ਜਾਂਚ ਕਰਨ ਅਤੇ ਸੰਚਾਰ ਦਾ ਪ੍ਰਬੰਧਨ ਕਰਨ ਦੀ ਪ੍ਰਕਿਰਿਆ ਹੋ ਸਕਦੀ ਹੈ ਜਿਸ ਨਾਲ ਕਈ ਵਾਰ ਗਲਤਫਹਿਮੀਆਂ ਹੋ ਸਕਦੀਆਂ ਹਨ ਇਹਨਾਂ ਮੁੱਦਿਆਂ ਦੇ ਬਾਵਜੂਦ ਸੁਵਿਧਾਵਾਂ ਅਤੇ ਵਿਕਲਪਾਂ ਦੀ ਰੇਂਜ ਇਹਨਾਂ ਪਲੇਟਫਾਰਮਾਂ ਨੂੰ ਉਹਨਾਂ ਦੀ ਪ੍ਰਸਿੱਧ ਵਿਕਲਪ ਬਣਾਉਂਦੀ ਹੈ ਜੋ ਕੰਮ ਸੌਂਪਣ ਜਾਂ ਮੰਗਣ 'ਤੇ ਵਿਸ਼ੇਸ਼ ਹੁਨਰ ਲੱਭਣ ਦੀ ਕੋਸ਼ਿਸ਼ ਕਰਦੇ ਹਨ